ਪੰਜਾਬ ਦੇ ਸਿੱਖਿਆ ਪ੍ਰਣਾਲੀ ਵਿੱਚ ਪੰਜਾਬੀ ਭਾਸ਼ਾ ਦਾ ਅਹੰਕਾਰ ਪੂਰਨ ਭੂਮਿਕਾ ਹੈ ਇਹ ਭਾਸ਼ਾ ਪੰਜਾਬੀ ਮਾਤਰ ਭਾਸ਼ਾ ਦੇ ਤੌਰ 'ਤੇ ਸਿੱਖਿਆ ਦੇ ਵੱਧ ਵੱਖ ਵੱਖ ਪੱਧਰਾਂ 'ਤੇ ਵਰਤੀ ਜਾਂਦੀ ਹੈ ਸਕੂਲ ਸਿੱਖਿਆ ਬੱਚਿਆਂ ਦੀ ਪ੍ਰਾਈਮਰੀ ਅਤੇ ਸੈਕੰਡਰੀ ਸਿੱਖਿਆ ਵਿੱਚ ਪੰਜਾਬੀ ਦੇ ਪਾਠਕ੍ਰਮ ਦਾ ਇੱਕ ਮੁੱਖ ਹਿੱਸਾ ਹੈ ਬਹੁਤ ਸਾਰੇ ਸਕੂਲਾਂ ਵਿੱਚ ਪੰਜਾਬੀ ਦੇ ਰੂਪ ਵਿੱਚ ਪੜ੍ਹਾਈ ਜਾਂਦੀ ਹੈ ਜਿਸ ਨਾਲ ਬੱਚਿਆਂ ਨੂੰ ਆਪਣੀ ਸੰਸਕ੍ਰਿਤਿਕ ਪਛਾਣ ਅਤੇ ਸਹੀ ਲਿਪੀ ਦੀ ਸਮਝ ਮਿਲਦੀ ਹੈ ਹਾਇਰ ਸਿੱਖਿਆ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਪੰਜਾਬੀ ਭਾਸ਼ਾ ਦਾ ਅਧਿਐਨ ਕੀਤਾ ਜਾਂਦਾ ਹੈ ਪੰਜਾਬੀ ਸਾਹਿਤ ਇਤਿਹਾਸ ਅਤੇ ਲਿੰਗੁਇਸਟਿਕ ਵਰਗੇ ਵਿਸ਼ਿਆਂ ਵਿੱਚ ਪੀ ਐਚ ਡੀ ਅਤੇ ਮਾਸਟਰਜ ਦੇ ਕੋਰਸ ਮੁਹੱਈਆ ਕੀਤੇ ਜਾਂਦੇ ਹਨ ਸਾਖੀ ਅਤੇ ਰਿਸਰਚ ਪੰਜਾਬੀ ਭਾਸ਼ਾ ਵਿੱਚ ਪੈਡਾਗੋਜੀਕਲ ਸਟਡੀਜ ਅਤੇ ਰਿਸਰਚ ਕਿਤਾਬਾਂ ਦੇ ਜਰਨਾ ਲਈ ਨਵੀਨ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਸਿੱਖਿਆ ਦੇ ਮਿਆਰ ਨੂੰ ਵਧਾਇਆ ਜਾਂਦਾ ਹੈ ਇਸ ਤਰ੍ਹਾਂ ਪੰਜਾਬੀ ਭਾਸ਼ਾ ਪੰਜਾਬੀ ਸਿੱਖਿਆ ਪ੍ਰਣਾਲੀ ਦਾ ਅਟੁੱਟ ਹਿੱਸਾ ਹੈ ਜੋ ਸੰਸਕ੍ਰਿਤਿਕ ਵਿਰਾਸਤ ਨੂੰ ਸੁਰੱਖਿਅਤ ਕਰਨ ਅਤੇ ਬੱਚਿਆਂ ਨੂੰ ਸਥਾਨਕ ਅਤੇ ਰਾਸ਼ਟਰ ਵਿਆਪੀ ਅਵਲੋਕਨ ਪ੍ਰਦਾਨ ਕਰਨ ਵਿੱਚ ਸਹਾਇਕ ਹੈ